ਮੈਨੂੰ ਲੱਗਦਾ ਇਹ ਕਿਸੇ ਵੀ ਮਨੁੱਖ ਦੀ ਆਪਣੀ ਖੁਦ ਦੀ ਜਿੰਮੇਵਾਰੀ ਹੈ ਉਹਦਾ ਆਪਣਾ ਫਰਜ਼ ਹੈ ਕਿ ਉਹ ਉਹ ਨਾ ਕੇਵਲ ਸਾਈਕਲ ਬਲਕਿ ਕਿਸੇ ਵੀ ਤਰ੍ਹਾਂ ਦਾ ਵਾਹਨ ਚਲਾਉਣ ਵੇਲੇ ਉਥੋਂ ਦੇ ਨਿਯਮਾਂ ਦਾ ਪਾਲਣਾ ਕਰੇ ਟਰੈਫਿਕ ਨਿਯਮਾਂ ਦਾ ਪਾਲਣਾ ਕਰੇ ਤਾਂ ਜੋ ਉਹ ਨਾ ਕੇਵਲ ਆਪਣੀ ਸੁਰੱਖਿਆ ਰੱਖ ਸਕੇ ਅਤੇ ਨਾਲ ਕਿਸੇ ਵੀ ਜਿਹੜਾ ਬੰਦਾ ਸੜਕ 'ਤੇ ਜਾਂਦਾ ਹੋਵੇ ਉਹਦੀ ਅਤੇ ਇਸ ਤੋਂ ਇਲਾਵਾ ਕਿਸੇ ਵੀ ਜਾਨਵਰ ਦੀ ਸਿਹਤ ਨੂੰ ਨੁਕਸਾਨ ਨਾ ਪਹੁੰਚਾਵੇ ਵਾਹਨ ਚਲਾਉਣ ਵੇਲੇ ਸਾਨੂੰ ਕੁਝ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜਾ ਵੀ ਵਿਅਕਤੀ ਅਠਾਰਾਂ ਸਾਲ ਤੋਂ ਘੱਟ ਹੈ ਉਸਨੂੰ ਸਾਈਕਲ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਦਾ ਵਾਹਨ ਨਹੀਂ ਚਲਾਉਣਾ ਚਾਹੀਦਾ ਅਤੇ ਵਾਹਨ ਚਲਾਉਣ ਸਮੇਂ ਉਸਨੂੰ ਆਪਣਾ ਡਰਾਈਵਿੰਗ ਲਾਈਸੈਂਸ ਗੱਡੀ ਦਾ ਇੰਸ਼ੋਰੈਂਸ ਅਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਦਸਤਾਵੇਜ਼ ਹਨ ਜਿ ਜਿਸ ਨੂੰ ਉਸਨੂੰ ਨਾਲ ਰੱਖਣਾ ਚਾਹੀਦਾ ਹੈ